ਭਾਰਤ ਦੀ ਆਜ਼ਾਦੀ ਦੀ ਲਹਿਰ ਜੋ ਕਿ ਅਠਾਰ੍ਹਾਂ ਸੌ ਸਤਵੰਜਾ ਤੋਂ ਲੈ ਕੇ ਉੱਨੀ ਸੌ ਸੰਤਾਲੀ ਤੱਕ ਚੱਲੀ ਅਤੇ ਇਸ ਦੇ ਦੌਰਾਨ ਇਸ ਵਿੱਚ ਹੋਈਆਂ ਬਹੁਤ ਸਾਰੀਆਂ ਘਟਨਾਵਾਂ ਸ਼ਹਾਦਤਾਂ ਅਤੇ ਨੇਤਾਵਾਂ ਦੀਆਂ ਸ਼ਹਾਦਤਾਂ ਸਾਨੂੰ ਬਹੁਤ ਹੀ ਪ੍ਰਭਾਵਿਤ ਕਰਦੀਆਂ ਹਨ ਜਿਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਇਸ ਦੇ ਵਿੱਚ ਲੋ ਆਮ ਜਨਤਾ 'ਤੇ ਵੀ ਕਾਫੀ ਪ੍ਰਭਾਵ ਪਿਆ ਆਮ ਜਨਤਾ ਵੀ ਸ਼ਹੀਦ ਹੋਈ ਜਿਸ ਦੇ ਨਾਲ ਨਾਲ ਉਹਨਾਂ ਦਾ ਜਿਹੜਾ ਇਸ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਰਿਹਾ ਸੀ ਅਤੇ ਕੁਝ ਨੇਤਾਵਾਂ ਦਾ ਵੀ ਯੋਗਦਾਨ ਰਿਹਾ ਸੀ ਅਤੇ ਇਸ ਤੋਂ ਬਾਅਦ ਸਾਡੇ ਕੁਝ ਮਹਾਨ ਸ਼ਹੀਦ ਜਿਹੜੇ ਕਿ ਸਾਨੂੰ ਜਿਹਨਾਂ ਨੂੰ ਅਸੀਂ ਹੁਣ ਵੀ ਯਾਦ ਕਰਦੇ ਹਾਂ ਭਗਤ ਸਿੰਘ ਸਰਦਾਰ ਊਧਮ ਸਿੰਘ ਅਤੇ ਹੋਰਾਂ ਨੂੰ ਵੀ ਅਸੀਂ ਯਾਦ ਕਰਦੇ ਹਾਂ ਜਿਹਨਾਂ ਨੇ ਉਹਨਾਂ ਦੇਸ਼ ਲਈ ਕੁਰਬਾਨੀਆਂ ਕੀਤੀਆਂ ਅਤੇ ਸਾਨੂੰ ਅੱਜ ਇਸ ਆਜ਼ਾਦੀ ਤੱਕ ਆਜ਼ਾਦੀ ਦੇ ਮੁਕਾਮ ਤੱਕ ਪਹੁੰਚਾਇਆ ਉੱਨੀ ਸੌ ਸੰਤਾਲੀ ਦੇ ਪਹਿਲਾਂ ਹੀ ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ ਸਨ ਜਿੱਦਾਂ ਜਿਵੇਂ ਕਿ ਜਲ੍ਹਿਆਂ ਵਾਲੇ ਬਾਗ ਦਾ ਅਸੀਂ ਇਤਿਹਾਸ ਜਾਣਦੇ ਹਾਂ ਉੱਥੇ ਜਰਨਲ ਡਾਇਰ ਨੇ ਨਜ਼ਾਇਜ਼ ਹੀ ਕੁਝ ਲੋਕਾਂ ਨੂੰ ਮਰਵਾਇਆ ਸੀ ਅਤੇ ਨਜਾਇਜ਼ ਗੋਲੀਆਂ ਚਲਵਾ ਕੇ ਆਮ ਜਨਤਾ ਨੂੰ ਕਤਲੇਆਮ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਹੋਈਆਂ ਸਨ ਜਿਸ ਦੇ ਵਿੱਚ ਆਮ ਜਨਤਾ ਦੀ ਜਾਨ ਹਮੇਸ਼ਾ ਜਾਂਦੀ ਰਹੀ ਸੀ ਈਸਟ ਇੰਡੀਆ ਕੰਪਨੀ ਵੱਲੋਂ ਕੀਤੇ ਗਏ ਇਹ ਕਾਰਨਾਮਿਆਂ ਨੂੰ ਅੱਜ ਵੀ ਭਾਰਤ ਯਾਦ ਕਰਦਾ ਹੈ ਅਤੇ ਆਪਣੀ ਸ਼ਹਾਦਤਾਂ ਨੂੰ ਭਾਰਤ ਯਾਦ ਕਰਦਾ ਹੈ ਜਿਸ ਦੇ ਵਿੱਚ ਸਾਨੂੰ ਮਾਣ ਹੁੰਦਾ ਹੈ ਆਪਣੇ ਭਾਰਤੀਏ ਹੋਣ 'ਤੇ ਅਤੇ ਉਹਨਾਂ ਸ਼ਹਾਦਤਾਂ ਨੂੰ ਯਾਦ ਕਰਨ 'ਤੇ ਕਿ ਸਾਡੇ ਭਾਰ ਭਾਰਤ ਮਹਾਨ ਵਿੱਚ ਇਨ ਸਭ ਸ ਖਾਸ ਸ਼ਖਸ਼ੀਅਤਾਂ ਨੇ ਜਨਮ ਲਿਆ ਅਤੇ ਅੱਜ ਸਾਨੂੰ ਇਹ ਮੁਕਾਮ ਤੱਕ ਪਹੁੰਚਾਇਆ